ਮੈਨੂੰ ਦੌੜਨ ਦਾ ਬਹੁਤ ਸ਼ੌਕ ਹੈ ਮੈਂ ਮੇਰੇ ਸਕੂਲ ਵਿੱਚ ਕੋਈ ਵੀ ਐਕਟੀਵਿਟੀ ਹੁੰਦੀ ਹੈ ਤਾਂ ਮੈਂ ਉਸ ਵਿੱਚ ਦੌੜਨ ਵਿੱਚ ਪਾਰਟੀਸਪੇਟ ਕਰਦੀ ਹਾਂ ਮੈਂ ਉਸ ਵਿੱਚ ਪਾਰਟੀਸਪੇਟ ਕਰਦੀ ਹਾਂ ਅਤੇ ਮੈਂ ਉਸ ਉਸ ਵਿੱਚ ਜਿੱਤ ਕੇ ਹੀ ਆਉਂਦੀ ਹਾਂ ਮੈਨੂੰ ਬਹੁਤ ਸਾਰੇ ਮੈਡਲ ਮਿਲੇ ਹੋਏ ਹਨ ਜਿਵੇਂ ਕਿ ਮੈਂ ਉਸ ਵਿੱਚ ਪਾਰਟੀਸਪੇਟ ਕਰਦੀ ਹਾਂ ਦੌੜਨਾ ਹਰੇ ਹਰ ਇੱਕ ਬੰਦੇ ਨੂੰ ਦੌੜਨਾ ਚਾਹੀਦਾ ਹੈ ਜਾਂ ਕਿਸੇ ਵੀ ਫਿਜੀਕਲ ਐਕਟੀਵਿਟੀ ਵਿੱਚ ਪਾਰਟੀਸਪੇਟ ਕਰਨਾ ਚਾਹੀਦਾ ਹੈ ਜਿਸ ਨਾਲ ਉਹ ਤੰਦਰੁਸਤ ਰਹਿੰਦਾ ਹੈ ਅਤੇ ਦੌੜਨ ਨਾਲ ਉਹ ਐਨ ਫਿੱਟ ਵੀ ਰਹਿੰਦਾ ਹੈ ਜਿਸ ਨਾਲ ਉਸ ਨੂੰ ਉਹ ਸਹੀ ਮਹਿਸੂਸ ਕਰਦਾ ਹੈ ਹਰ ਮੈਨੂੰ ਵੀ ਦੌ ਮੈਂ ਦੌੜਨ ਵਿੱਚ ਬਹੁਤ ਹੀ ਮੈਨੂੰ ਦੌੜਨ ਦਾ ਬਹੁਤ ਹੀ ਸ਼ੌਕ ਹੈ ਮੈਂ ਹਰ ਇੱਕ ਐਕਟੀਵ ਮੇਰੇ ਸਕੂਲ ਦੀ ਕੋਈ ਵੀ ਐਕਟੀਵਿਟੀ ਹੁੰਦੀ ਹੈ ਮੈਂ ਉਸ ਵਿੱਚ ਪਾਰਟੀਸਪੇਟ ਜ਼ਰੂਰ ਕਰਦੀ ਹਾਂ ਅੱਜ ਕੱਲ੍ਹ ਦੇ ਲੋਕ ਦੌੜਨ ਤੋਂ ਬਹੁਤ ਹੀ ਬਹੁਤ ਹੀ ਕਤਰਾਉਂਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇਕਰ ਅਸੀਂ ਜੇਕਰ ਅਸੀਂ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਿਆ ਤਾਂ ਸਾਡੀ ਸਿਹਤ ਹੋਰ ਵੀ ਖਰਾਬ ਹੋ ਸਕਦੀ ਹੈ ਇਸ ਲਈ ਹਰ ਇੱਕ ਬੰਦੇ ਨੂੰ ਫਿਜਕਲ ਐਕਟੀਵਿਟੀ ਵਿੱਚ ਪਾਰਟੀਸਪੇਟ ਕਰਨਾ ਚਾਹੀਦਾ ਹੈ